ਹਾਂਜੀ ਸਰ ਮੈਂ ਰਮਨਪ੍ਰੀਤ ਕੌਰ ਲੁਧਿਆਣੇ ਤੋਂ ਗੱਲ ਕਰ ਰਹੀ ਹਾਂ ਜੀ ਹਾਂਜੀ ਤੁਹਾਡੀ ਫਰਨੀਚਰ ਦੀ ਸ਼ੋਪ ਹੈ ਜੀ ਓਕੇ ਜੀ ਅਸੀਂ ਨਾ ਇੱਕ ਬੈੱਡ ਦੇਖਣਾ ਸੀਗਾ ਹਾਂਜੀ ਅਤੇ ਬੈੱਡ ਦਾ ਤੁਸੀਂ ਦੱਸੋਗੇ ਕਿਹੜੀ ਕਿਹੜੇ ਮਤਲਬ ਤੁਹਾਡੇ ਕੋਲ ਕਿੱਦਾਂ ਦੇ ਬੈੱਡ ਬਣੇ ਹੋਏ ਨੇ ਨਹੀਂ ਦੋਨੇਂ ਦੇਖਣੇ ਜੀ ਠੀਕ ਹੈ ਜੀ ਸਾਨੂੰ ਡਬਲ ਬੈੱਡ ਚਾਹੀਦੇ ਜੀ ਡਬਲ ਬੈੱਡ ਬੋਕਸ ਹੋਵੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸਨਮਾਇਕਾ ਵਗੈਰਾ ਕਿੱਦਾਂ ਦਾ ਲੱਗਿਆ ਹੋਊਗਾ ਇਹਦੇ 'ਤੇ ਠੀਕ ਹੈ ਜੀ ਠੀਕ ਅੱਛਾ ਇੱਕ ਨਾ ਉਹ ਥੋੜ੍ਹੇ ਜਿਹੇ ਸਟਾਈਲਿੰਗ ਜਿਹੇ ਬੈੱਡ ਹੁੰਦੇ ਆ ਜਿੱਦਾਂ ਉਨ੍ਹਾਂ ਢੋਅ 'ਤੇ ਸਟਾਇਲ ਬਣਿਆ ਵਾ ਹੋਇਆ ਹੁੰਦਾ ਵਧੀਆ ਲੱਕੜ ਦੇ ਹੁੰਦੇ ਹੈ ਉਹ ਉੱਦਾਂ ਦੀ ਡਿਜ਼ਾਇਨਿੰਗ ਵਾਲੇ ਬੈੱਡ ਹੋਣਗੇ ਤੁਹਾਡੇ ਕੋਲ ਅੱਛਾ ਜੀ ਤੁਸੀਂ ਬਣਾਉਂਦੇ ਵੀ ਹੋ ਆਪ ਖੁਦ ਠੀਕ ਹੈ ਜੀ ਅਤੇ ਫਿਰ ਜਿੱਦਾਂ ਕੋਈ ਤੁਸੀਂ ਮਤਲਬ ਪੂਰਾ ਆਪਾਂ ਪ੍ਰੋਪਰ ਸੈੱਟਅਪ ਬਣਾਉਣਾ ਹੁੰਦਾ ਨਾ ਵੀ ਇੱਕ ਸਨਮਾਇਕਾ ਵਗੈਰਾ ਜੇ ਇੱਕ ਲੱਕੜ ਦਾ ਵੀ ਜਿਵੇਂ ਨਾਲ ਸੋਫਾ ਵਗੈਰਾ ਅਤੇ ਉਨ੍ਹਾਂ ਦਾ ਜਿਵੇਂ ਮੇਜ ਵਗੈਰਾ ਹੁੰਦਾ ਉੱਦਾਂ ਦਾ ਜਾਂ ਆਪਾਂ ਡਾਈਨਿੰਗ ਟੇਬਲ ਇੱਦਾਂ ਸਟਡੀ ਟੇਬਲ ਹੋ ਗਿਆ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਇਸ ਦੀ ਗੱਲ ਕਰ ਰਹੀ ਸੀਗੀ ਮੈਂ ਠੀਕ ਹੈ ਜੀ ਹਾਂਜੀ

ਠੀਕ ਹੈ ਜੀ ਅਤੇ ਫਿਰ ਪੋ ਇਹ ਪੋਲਿਸ਼ ਵਾਲਾ ਵਧੀਆ ਨਾ ਸਾਨੂੰ ਕਿਉਂਕਿ ਫਿਰ ਇੱਕ ਤਰ੍ਹਾਂ ਦਾ ਮਤਲਬ ਸਾਰਾ ਸੋਹਣਾ ਲੱਗਦਾ ਹੈਗਾ ਪਿਆ

ਠੀਕ ਹੈ ਜੀ ਉਹ ਵਿੱਚ ਰੱਖ ਕੇ ਫਿਰ ਤੁਸੀਂ ਹੋਰ ਮਤਲਬ ਪੈਸੇ ਲੈ ਕੇ ਫਿਰ ਦੇ ਦਉਗੇ ਸਾਨੂੰ ਹੈ ਨਾ ਠੀਕ ਹੈ ਜੀ ਸਸਤਾ ਕੁਆਲਟੀ ਕਿੱਦਾਂ ਦੀ ਹੋਊਗੀ ਸਰ ਕੁਆਲਟੀ ਬਾਰੇ ਦੱਸੋ ਮੈਨੂੰ ਨਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅਸੀਂ ਦੇਖਾਂਗੇ ਨਾ ਫਿਰ ਇੱਕ ਨਾਲ ਦੀ ਫਰਨੀਚਰ ਤਿਆਰ ਕਰਨਾ ਹੈਗਾ ਸਾਰਾ ਅਤੇ ਉਹ ਫਿਰ ਅਸੀਂ ਉਵੇਂ ਦਾ ਤੁਸੀਂ ਓਡਰ ਉੱਤੇ ਸਾਨੂੰ ਤਿਆਰ ਕਰ ਦਿਓ ਓਕੇ ਜੀ ਓਕੇ ਥੈਂਕ ਯੂ ਸਰ ਓਕੇ ਜੀ